ਅੰਮ੍ਰਿਤਸਰ ਭਾਰਤ ਵਿੱਚ ਕੱਪੜੇ ਦੇ ਉਦਯੋਗ ਲਈ ਸਭ ਤੋਂ ਪ੍ਰਸਿੱਧ ਹੈ ਅੰਮ੍ਰਿਤਸਰ ਪਸ਼ਮੀਨਾ ਸ਼ਾਲ ਲਈ ਸਭ ਤੋਂ ਪ੍ਰਸਿੱਧ ਹੈ ਅੰਮ੍ਰਿਤਸਰ ਵਿੱਚ ਔਡੀਓ ਵੀਡੀਓ ਯੰਤਰ ਵੀ ਬਣਾਏ ਜਾਂਦੇ ਹਨ ਬੁਲਟ ਟੈਕ ਅਤੇ ਸਪਰਿੰਗ ਕੰਟੇ ਕੰਟੇਨਰ ਵੀ ਬਣਾਏ ਜਾਂਦੇ ਹਨ ਅੰਮ੍ਰਿਤਸਰ ਵਿੱਚ ਖੇਤੀਬਾੜੀ ਵੀ ਇੱਕ ਬਹੁਤ ਲਾਭਦਾਇਕ ਉਦਯੋਗ ਹੈ ਭੋਜਨ ਨੂੰ ਘਰ ਘਰ ਪਹੁੰਚਾਉਣਾ ਅਤੇ ਵਿਆਹ ਸ਼ਾਦੀ ਵਿੱਚ ਕੈਟਰਿੰਗ ਕਰਨਾ ਵੀ ਇੱਕ ਬੜਾ ਵਧੀਆ ਉਪਯੋਗ ਅਤੇ ਕਾਰੋਬਾਰ ਲਾਭਦਾਇਕ ਹੈ ਡੇਰੀਆਂ 'ਤੇ ਦੁੱਧ ਵੇਚਣ ਦਾ ਕਾਰੋਬਾਰ ਵੀ ਲਾਭਦਾਇਕ ਹੈ ਫੁਲਕਾਰੀ ਦਾ ਵੀ ਉਦਯੋਗ ਬਹੁਤ ਮਹੱਤਵਪੂਰਨ ਹੈ ਬੀਜ ਪੈਦਾ ਕਰਨ ਵਾਲੇ ਦਾ ਉਦਯੋਗ ਵੀ ਬਹੁਤ ਲਾਭਦਾਇਕ ਹੈ ਆਟੋਮੋਬਾਈਲ ਮੁਰੰਮਤ ਕਰਨਾ ਕਰਨ ਦਾ ਵੀ ਕਾਰੋਬਾਰ ਬਹੁਤ ਲਾਭਦਾਇਕ ਹੈ ਅੰਮ੍ਰਿਤਸਰ ਵਿੱਚ ਵੱਖ ਵੱਖ ਚੀਜ਼ਾਂ ਨੂੰ ਬਣਾਉਣ ਲਈ ਵੱ ਬਣਾਉਣ ਲਈ ਕਾਰਖਾਨੇ ਲੱਗੇ ਹੋਏ ਹਨ ਜਿਵੇਂ ਕਿ ਪੈਨ ਪਨਿਸ ਪੇਪਰ ਕਟਿੰਗ ਇੰਜੀਨੀਅਰ ਗੁਡਸ ਟੈਕਸਟਾਇਲ ਮਸ਼ੀਨਾਂ ਅਤੇ ਲੱਕੜ ਦੀ ਮਸ਼ੀਨਾਂ ਦੇ ਸਕਿਊਟ ਪੇਂਟਿੰਗ ਅਤੇ ਮਸ਼ੀ ਮਸ਼ੀਨਰੀ ਬਿਜਲੀ ਦੇ ਪੱਖੇ ਕੈਮੀਕਲ ਅਤੇ ਕੱਪੜੇ ਸਿ ਨੂੰ ਕੈਮੀਕਲ ਅਤੇ ਕੱਪੜੇ ਜਿਵੇਂ ਕਿ ਸੂਤੀ ਉੱਨੀ ਰੇਸ਼ਮੀ ਵੀ ਸ਼ਾਮਿਲ ਹਨ ਇਹ ਸਾਰੇ ਉਦਯੋਗ ਸਾਨੂੰ ਅੰਮ੍ਰਿਤਸਰ ਦੇ ਮਹੱਤਵਪੂਰਨ ਹਨ ਸਮੇਂ ਦੇ ਨਾਲ ਨਾਲ ਇਹ ਉਦਯੋਗ ਹੋਰ ਵਿਕਸਿਤ ਹੋ ਗਏ ਹਨ ਇਨ੍ਹਾਂ ਉਦਯੋਗਾਂ ਦੀ ਸਿਖਲਾਈ ਲਈ ਔਨਲਾਈਨ ਟਿਊਸ਼ਨਾ ਕਲਾਸਾਂ ਘੱਟ ਕੀਮਤ 'ਤੇ ਲੱਗਦੀਆਂ ਹਨ ਜਿਸ ਕਰਕੇ ਔਨਲਾਈਨ ਦੀ ਮਦਦ ਨਾਲ ਹੋਰ ਵੀ ਸਿਖਲਾਈ ਲੈ ਕੇ ਆਪਣੇ ਉਦਯੋਗ ਵਿੱਚ ਸਫਲ ਹੋ ਸਕਦੇ ਹਨ ਅੰਮ੍ਰਿਤਸਰ ਵਿੱਚ ਸਭ ਤੋਂ ਜ਼ਿਆਦਾ ਸੈਲਾਨੀ ਅੰਮ੍ਰਿਤਸਰ ਵਿੱਚ ਆਉਂਦੇ ਹਨ ਅਤੇ ਇਸ ਲਈ ਟਰੈਵਲ ਏਜੰਸੀ ਦਾ ਕੰਮ ਬਹੁਤ ਚੱਲਦਾ ਹੈ ਅਤੇ ਜਿਸ ਕਰਕੇ ਇਸ ਦਾ ਮੁਕਾਬਲਾ ਬਹੁਤ ਵੱਧ ਗਿਆ ਹੈ ਇੱਥੇ ਕੁੱਤੇ ਵੀ ਪਾਲੇ ਜਾਂਦੇ ਹਨ ਅਤੇ ਉਨ੍ਹਾਂ ਦਾ ਵਪਾਰ ਵੀ ਬਹੁਤ ਵਧੀਆ ਚੱਲਦਾ ਹੈ ਘਰਾਂ ਵਿੱਚ ਗੁਰਦੁਆਰਿਆਂ ਵਿੱਚ ਵਿਆਹ ਸ਼ਾਦੀ ਵਿੱਚ ਬੱਚੇ ਦੇ ਜਨਮ ਦਿਨ 'ਤੇ ਵਿਆਹ ਦੀ ਸਾਲਗਿਰਾ 'ਤੇ ਸੱਜ ਸਜਾਉਣ ਦਾ ਕੰਮ ਬਹੁਤ ਉੱਚੇ ਪੱਧਰ 'ਤੇ ਕੰਮ ਚਲਦਾ ਹੈ ਇਸ ਦਾ ਮੁਕਾਬਲਾ ਵੀ ਇੱਕ ਪੱਧਰ 'ਤੇ ਚੁਣੌਤੀ ਹੈ ਜਿਸ ਤਰ੍ਹਾਂ ਪਹਿਲਾ ਹਲਵਾਈ ਕੰਮ ਕਰਦੇ ਸੀ ਪਰ ਅੱਜ ਕੱਲ੍ਹ ਦੀਆਂ ਤੀਵੀਆਂ ਪਿੱਛੇ ਨਹੀਂ ਰਹੀਆਂ ਉਹਨਾਂ ਨੇ ਘਰ ਵਿੱਚ ਬੈਠੇ ਭੋਜਨ ਦੇ ਪਕਵਾਨ ਤਰ੍ਹਾਂ ਤਰ੍ਹਾਂ ਦੀ ਘਰਾਂ ਵਿੱਚ ਖ਼ਾਸ ਕਰਕੇ ਖ਼ਾਸ ਮੌਕੇ 'ਤੇ ਪਹੁੰਚਾਉਂਦੀਆਂ ਹਨ ਅਤੇ ਹਲਵਾਈਆਂ ਦੇ ਲਈ ਇਹ ਬਹੁਤ ਵੱਡੀ ਚੁਣੌਤੀ ਹੈ